ਜਿਵੇਂ ਕਿ ਬਹੁਤ ਸਾਰੇ ਆਵਾਜਾਈ ਸੰਬੰਧਿਤ ਚੁਨੌਤੀਆਂ ਹੋ ਜਾਂਦੀਆਂ ਨੇ ਕੋਈ ਆਵਾਜਾਈ ਦੇ ਜਿਹੜੇ ਸਾਧਨ ਹੁੰਦੇ ਨੇਗੇ ਕੋਈ ਵੀ ਗਰਮੀ ਸਰਦੀ ਹੋਵੇ ਕੋਈ ਮੀਂਹ ਮੀਂਹ ਆ ਜਾਂਦਾ ਹੈ ਜਿਸ ਕਰਕੇ ਜਿਹੜੀ ਆਵਾਜਾਈ ਹੈਗੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਉੱਥੇ ਜਿਹੜੇ ਆਵਾਜਾਈ ਦੇ ਸਾਧਨ ਨੇ ਰੁੱਕ ਜਾਂਦੇ ਨੇ ਜਿਸ ਨਾਲ ਕਿਤੇ ਵੀ ਸਾਨੂੰ ਜਾਣ ਦੀ ਦਿੱਕਤ ਬਹੁਤ ਜ਼ਿਆਦਾ ਪੈਦਾ ਹੋ ਜਾਂਦੀ ਹੈ ਜਿਵੇਂ ਕਿ ਅਸੀਂ ਕਿਸੇ ਵੀ ਨੇੜਲੇ ਸ਼ਹਿਰ ਦੀ ਯਾਤਰਾ ਕਰਦੇ ਹਾਂ ਅਤੇ ਉੱਥੇ ਕੋਈ ਵੀ ਸਹੂਲਤ ਜਾਂ ਆਵਾਜਾਈ ਸੰਬੰਧੀ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਵੀ ਕੋਈ ਵੀ ਕਿਤੇ ਬਾਰਿਸ਼ ਹੋ ਜਾਂਦੀ ਹੈ ਕਿਤੇ ਵੀ ਟਰੈਫਿਕ ਜਾਮ ਹੋ ਜਾਂਦੀ ਜਿੱਥੇ ਵੀ ਅਸੀਂ ਜਲਦੀ ਪਹੁੰਚਣਾ ਹੁੰਦਾ ਤਾਂ ਅਸੀਂ ਉੱਥੇ ਪਹੁੰਚਣਾ ਹੀ ਪਹੁੰਚ ਹੀ ਚੁੱਕ ਸਕਦੇ ਹੁੰਦੇ ਹੈ ਕਿਉਂਕਿ ਟਾਈਮ ਬਹੁਤ ਹੀ ਜ਼ਿਆਦਾ ਘੱਟ ਹੋ ਜਾਂਦਾ ਹੈ ਟਰੈਫਿਕ ਬਹੁਤ ਹੀ ਜ਼ਿਆਦਾ ਹੋ ਜਾਂਦੀ ਹੈ ਜਿਸ ਦੇ ਨਾਲ ਅਸੀਂ ਜਾਣੇ ਸਕਦੇ ਇਸ ਤਰ੍ਹਾਂ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਗਾ